ਯਾਤਰਾਂ ਤਾਂ ਅਸੀਂ ਬਹੁਤ ਕੀਤੀਆਂ ਹਨ ਪਰ ਇਹਨਾਂ ਵਿੱਚੋਂ ਇੱਕ ਯਾਦਗਾਰ ਯਾਤਰਾ ਸਾਡੀ ਅੰਬਰਸਰ ਦੀ ਰਹੀ ਅਸੀਂ ਆਪਣੇ ਪਰਿਵਾਰ ਨਾਲ ਅੰਬਰਸਰ ਜਾਣ ਲਈ ਤਿਆਰ ਹੋ ਗਏ ਸੂਬਹਾ ਜਲਦੀ ਉੱਠੇ ਉੱਠ ਕੇ ਨਾਤੇ ਤੇ ਫੇਰ ਸਾਰਾ ਪਰਿਵਾਰ ਤਿਆਰ ਹੋ ਗਿਆ ਫੇਰ ਅਸੀਂ ਆਪਣੇ ਘਰੋਂ ਨਿਕਲੇ ਤੇ ਬੱਸ ਸਟੈਂਡ ਤੇ ਪਹੁੰਚੇ ਬੱਸ ਸਟੈਂਡ ਤੇ ਜਾਂਦਿਆਂ ਸਾਨੂੰ ਦੀਪ ਆਲਿਆਂ ਦੀ ਬੱਸ ਮਿਲੀ ਤੇ ਅਨ ਦੀਪ ਆਲਿਆਂ ਦੀ ਬੱਸ ਤੇ ਅਸੀਂ ਚੜ੍ਹੇ ਫੇਰ ਚੜ੍ਹ ਕੇ ਸਾਡ ਅੰਦਰੋਂ ਬਹੁਤ ਸੋਹਣੀ ਸਜਾਈ ਹੋਈ ਸੀ ਕਨੈਟਰ ਡਰੈਵਰ ਦੀਆਂ ਸੀਟਾਂ ਵੀ ਬਹੁਤ ਸੋਹਣੀਆਂ ਸੱਜੀਆਂ ਹੋਈਆਂ ਸਨ ਸਾਡੇ ਬੈਠਣ ਲਈ ਵੀ ਸੀਟਾਂ ਤੇ ਬਹੁਤ ਸੋਹਣਾ ਸਜਾਇਆ ਹੋਇਆ ਸੀ ਤੇ ਸਾਡੇ ਸਿਰ ਦੇ ਉੱਪਰ ਕੈਬਨ ਲੱਗਿਆ ਹੋਇਆ ਸੀ ਜੋ ਸਮਾਨ ਰੱਖਣ ਲਈ ਬਨਾਇਆ ਗਿਆ ਸੀ ਫੇਰ ਅਸੀਂ ਸ਼ੀਸ਼ੇ ਆਲੇ ਬਾਰੀਆਂ ਵੀ ਸਾਫ ਸੁਥਰੀਆਂ ਸਨ ਅੰਦਰੋਂ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਸਨ ਤੇ ਇਹਨੇ ਨੂੰ ਅਸੀਂ ਸਾਰਾ ਪਰਿਵਾਰ ਸੀਟਾਂ ਤੇ ਬੈਠੇ ਤੇ ਕੁਝ ਯਾਤਰੀ ਵੀ ਚੜ੍ਹੇ ਫੇਰ ਅਸੀਂ ਚੜ੍ਹੇ ਤੇ ਉਹ ਇਨੇ ਨੂੰ ਕਨੈਟਰ ਨੇ ਸੀ ਟਿਕਟਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਅਗਲੇ ਸਟੋਪ ਤੇ ਯਾਤਰੀ ਹੋਰ ਚੜ੍ਹ ਗਏ ਅਸੀਂ ਉਹਨਾਂ ਯਾਤਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾਨਾ ਏ ਉਹਨਾਂ ਨੇ ਅੰਬਰਸਰ ਜਾਣ ਲਈ ਕਿਹਾ ਅਸੀਂ ਸਾਰਿਆਂ ਨੇ ਆਪਣੇ ਗੱਲਬਾਤ ਕੀਤੀ ਤੇ ਤੇ ਅੰਬਰਸਰ ਜਾ ਆਹਾ ਜਾਨ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਪਰਿਵਾਰ ਦੀਆਂ ਗੱਲਾਂ ਬਾਤਾਂ ਕੀਤੀਆਂ ਅਸੀਂ ਰਾਸਤੇ ਵਿੱਚ ਵਾਹਿਗੁਰੂ ਦਾ ਜਾਪ ਕੀਤਾ ਜੋ ਅਸੀਂ ਘਰੇ ਬਨਾ ਕੇ ਲੈ ਕੇ ਗਏ ਸੀ ਚੀਜ਼ ਉਹ ਸਾਰੇ ਯਾਤਰੀ ਨੇ ਛਕਿਆ ਫੇਰ ਸ੍ਰੀ ਅੰਬਰਸਰ ਯਾਤਰਾ ਤੇ ਪਹੁੰਚ ਗਏ ਗੁਰਦੁਆਰਾ ਸਾਹਿਬ ਪਹੁੰਚੇ ਤੇ ਜੁੱਤੀਆਂ ਜਮ੍ਹਾਂ ਕਰਵਾਈਆਂ ਫੇਰ ਦਰਬਾਰ ਸਾਹਿਬ ਵਿੱਚ ਪਹੁੰਚੇ ਤੇ ਪ੍ਰਸ਼ਾਦ ਪ੍ਰਸ਼ਾਦ ਮੰਗਾ